ਹਾਂਜੀ ਸਕੂਲਾਂ ਵਿੱਚ ਵੀ ਕਿੱਤਾ ਮੁੱਖੀ ਸਿੱਖਿਆ ਦੇਣੀ ਚਾਹੀਦੀ ਹੈ ਜਿਵੇਂ ਤਰਖਾਣ ਪਲੰਬਿੰਗ ਸ ਸਿਲਾਈ ਪੋਲਟਰੀ ਅਤੇ ਪਸ਼ੂ ਪਾਲਣ ਕਿਉਂਕਿ ਇਹਨਾਂ ਕੰਮਾਂ ਨੂੰ ਅਗਰ ਸਟੂਡੈਂਟ ਸਿੱਖ ਲੈਂਦੇ ਹਨ ਤਾਂ ਉਹਨਾਂ ਨੂੰ ਕਿਸੇ ਥੱਲੇ ਕੰਮ ਕਰਨਾ ਨਹੀਂ ਪੈਣਾ ਸਗੋਂ ਉਹ ਆਪਣਾ ਕੰਮ ਸ਼ੁਰੂ ਕਰਕੇ ਆਪਣਾ ਜ਼ਿੰਦਗੀ ਨੂੰ ਅੱਗੇ ਵਧਾ ਸਕਦੇ ਹਨ ਕਿਸੇ ਥੱਲੇ ਕੰਮ ਕਰਨਾ ਵੀ ਇੱਕ ਤਰ੍ਹਾਂ ਦਾ ਨੌਕਰ ਦਾ ਹੀ ਕੰਮ ਹੁੰਦਾ ਹੈ ਬਟ ਅਸੀਂ ਅਗਰ ਛੋਟਾ ਜਿਹਾ ਕੰਮ ਵੀ ਆਪਣਾ ਸ਼ੁਰੂ ਕਰ ਲੈਂਦੇ ਹਾਂ ਤਾਂ ਅਸੀਂ ਆਪਣੇ ਕੰਮ ਦੇ ਖ਼ੁਦ ਮਾਲਿਕ ਹੁੰਦੇ ਚਾਹੇ ਛੋਟੇ ਹੀ ਹੋਈਏ ਤਾਂ ਕਰਕੇ ਬੱਚਿਆਂ ਨੂੰ ਕਿੱਤਾ ਮੁੱਖੀ ਸਿਖਲਾਈਆਂ ਸਕੂਲਾਂ ਵਿੱਚ ਦੇਣੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ ਸਟੂਡੈਂਟ ਹੌਲੀ ਹੌਲੀ ਇਹਨਾਂ ਵਿੱਚ ਆਪਣਾ ਰੁਝਾਨ ਖ਼ੁਦ ਬਣਾਉਣ ਲੱਗਣਗੇ ਜੇਕਰ ਇਹਨਾਂ ਨੂੰ ਸਿਖਲਾਈ ਦੇਣੀ ਸ਼ੁਰੂ ਕੀਤੀ ਜਾਵੇ ਅਤੇ ਪਹਿਲਾਂ ਵਾਲੇ ਸਮੇਂ ਦੇ ਵਿੱਚ ਵੀ ਇੱਦਾਂ ਹੀ ਕੰਮ ਕੀਤੇ ਜਾਂਦੇ ਸੀ ਅਤੇ ਆਪਣੇ ਘਰਾਂ ਘਰਾਂ ਦੇ ਰੁਜ਼ਗਾਰ ਚਲਾਏ ਜਾਂਦੇ ਸੀ ਅੱਜ ਕੱਲ੍ਹ ਦੇ ਬੱਚਿਆਂ ਨੂੰ ਜ਼ਿਆਦਾ ਰੁਝਾਨ ਬਾਹਰਲੇ ਬਾਹਰ ਭੱਜਣ ਦਾ ਹੈ ਪਰ ਜੋ ਸਾਡੇ ਪੰਜਾਬ ਵਿੱਚ ਕਿੱਤੇ ਹਨ ਉਹ ਕਿਤੇ ਵੀ ਨਹੀਂ ਹਨ ਇਹਨਾਂ ਨੂੰ ਬਾਹਰ ਜਾ ਕੇ ਨਹੀਂ ਸਿੱਖ ਸਕਦੇ ਸਟੂ ਸਟੂਡੈਂਟ ਇਹਨਾਂ ਨੂੰ ਬਾਹਰ ਜਾ ਕੇ ਨਹੀਂ ਸਿੱਖ ਸਕਦੇ ਆਪਣੇ ਹੀ ਦੇਸ਼ ਵਿੱਚ ਰਹਿ ਕੇ ਆਪਣਾ ਹੀ ਕੰਮ ਸ਼ੁਰੂ ਕਰਨਾ ਬਹੁਤ ਹੀ ਵਧੀਆ ਚੀਜ਼ ਹੈ